ਮੇਰੇ ਸਭ ਤੋਂ ਮਨ ਪਸੰਦ ਅਧਿਆਪਕ ਪ੍ਰਭਜੋਤ ਕੌਰ ਹਨ ਅਤੇ ਮੈਨੂੰ ਉਹ ਦਸਵੀਂ ਜਮਾਤ ਤੋਂ ਹੀ ਪੜਾਉਂਦੇ ਆ ਰਹੇ ਹਨ